ਅਜਿਹਾ ਮੇਰੇ ਨਾਲ ਇੱਕ ਵਾਰੀ ਹੀ ਹੋਇਆ ਹੈ ਮੈਨੂੰ ਚਿੱਤਰਕਾਰੀ ਚਿੱਤਰ ਬਣਾਉਣ ਦਾ ਬਹੁਤ ਸ਼ੌਂਕ ਸੀਗਾ ਅਤੇ ਮੇਰੇ ਮੰਮੀ ਪਾਪਾ ਨੇ ਹੀ ਮੇਰੀ ਜਦੋਂ ਮੈਂ ਛੋਟੀ ਸੀਗੀ ਮਤਲਬ ਮੈਂ ਉਦੋਂ ਨੌਵੀਂ ਕਲਾਸ ਵਿੱਚ ਸੀਗੀ ਅਤੇ ਉਦੋਂ ਮੇਰੇ ਮੰਮੀ ਪਾਪਾ ਨੇ ਹੀ ਮੇਰੀ ਅਖਬਾਰ ਦੇ ਵਿੱਚ ਅਖਬਾਰ ਦਾ ਜੋ ਬੱਚਿਆਂ ਵਾਲਾ ਸ਼ਨੀਵਾਰ ਨੂੰ ਜੋ ਇੱਕ ਅਖਬਾਰ ਆਉਂਦੀ ਹੈ ਬੱਚਿਆਂ ਵਾਲੀ ਉਸ ਰਸਾਲੇ ਦੇ ਵਿੱਚ ਉਸ ਮਤਲਬ ਉਹ ਅਲੱਗ ਹੀ ਇੱਕ ਪੇਜ ਆਉਂਦਾ ਹੁੰਦਾ ਹੈ ਉਹਦੇ ਉੱਤੇ ਮਤਲਬ ਮੇਰੇ ਮੰਮੀ ਪਾਪਾ ਨੇ ਮਤਲਬ ਪੈਸੇ ਦੇਵਾ ਕੇ ਅਤੇ ਉੱਤੇ ਉੱਤੇ ਮੇਰਾ ਜਿਹੜਾ ਚਿੱਤਰ ਹੈਗਾ ਉਹ ਬਣਵਾਇਆ ਸੀ ਅਤੇ ਮਤਲਬ ਮੈਂ ਆਪਣੇ ਘਰ ਮਤਲਬ ਨਾ ਮੇਰੀ ਇੱਕ ਫਰੈ ਮਤਲਬ ਫਰੈਂਡ ਸੀ ਉਹ ਵੀ ਬਹੁਤ ਵਧੀਆ ਚਿੱਤਰ ਬਣਾਉਂਦੀ ਹੁੰਦੀ ਸੀ ਐਵੇਂ ਹੀ ਮਤਲਬ ਉਹਦਾ ਇੱਕ ਚਿੱਤਰ ਉਹਦੇ ਅਖਬਾਰ ਵਿੱਚ ਆਇਆ ਸੀ ਅਤੇ ਮੈਂ ਆਪਣਿਆਂ ਨੂੰ ਕਿਹਾ ਅਤੇ ਉਹਨਾਂ ਨੇ ਕਿਹਾ ਕੋਈ ਨਹੀਂ ਕਿ ਅਤੇ ਤੂੰ ਬਣਾ ਕੋਈ ਵਧੀਆ ਜਿਹਾ ਚਿੱਤਰ ਅਤੇ ਉਹ ਮਤਲਬ ਅਖਬਾਰ ਵਿੱਚ ਆਇਆ ਸੀਗਾ ਅਤੇ ਉਹ ਮੇਰੀ ਪੇਂਟਿੰਗ ਜੋ ਮੈਂ ਬਣਾਈ ਸੀਗੀ ਉਹ ਜੋ ਮੈਂ ਚਿੱਤਰ ਬਣਾਇਆ ਸੀਗਾ ਉਹਦਾ ਵਿਸ਼ਾ ਸੀਗਾ ਕਿ ਇੱਕ ਬੁੱਢੀ ਔਰਤ ਹੈ ਔਰ ਔਰਤ ਜੋ ਹੈ ਉਹ ਸੜਕ ਕਰੋਸ ਕਰ ਰਹੀ ਹੈ ਸੜਕ ਕਰੋਸ ਕਰ ਰਹੀ ਹੈ ਅਤੇ ਉਹਦੇ ਤੋਂ ਸੜਕ ਕਰੋਸ ਹੋ ਨਹੀਂ ਪਾ ਰਿਹਾ ਅਤੇ ਇੱਕ ਜਿਹੜਾ ਬੱਚਾ ਹੈ ਉੱਥੇ ਬਹੁਤ ਸਾਰੇ ਲੋਕ ਲੰਘ ਰਹੇ ਕਿਸੇ ਨੇ ਉਹਦੀ ਮਤਲਬ ਮਦਦ ਨਹੀਂ ਕੀਤੀ ਮਤਲਬ ਉਹਦੇ ਵਿੱਚ ਮੈਂ ਇੱਕ ਔਰਤ ਅਤੇ ਹੋਰ ਵੀ ਬਹੁਤ ਸਾਰੇ ਲੋਕ ਜੋ ਸੜਕ ਕਰੋਸ ਕਰ ਰਹੇ ਉਹਦੀ ਕਿਸੇ ਨੇ ਹੈਲਪ ਨਹੀਂ ਕੀਤੀ ਤਾਂ ਉਹਦਾ ਇੱਕ ਬੱਚਾ ਹੈਲਪ ਕਰਦਾ ਹੱਥ ਪਕੜ ਕੇ ਉਹਨੂੰ ਸੜਕ ਕਰੋਸ ਕਰਵਾ ਰਿਹਾ ਹੁੰਦਾ ਇਹ ਮੈਂ ਜਿਹੜਾ ਚਿੱਤਰ ਹੈ ਇਹ ਮੇਰਾ ਚਿੱਤਰ ਅਖਬਾਰ ਦੇ ਵਿੱਚ ਆਇਆ ਸੀਗਾ ਅਤੇ ਇਹ ਮੇਰਾ ਸਭ ਤੋਂ ਵਧੀਆ ਮਤਲਬ ਕਹਿ ਸਕਦੇ ਤੁਸੀਂ ਐਕਸਪੀਰੀਅੰਸ ਸੀਗਾ ਅਤੇ ਇਹ ਮੈਨੂੰ ਕਦੇ ਵੀ ਮਤਲਬ ਕਦੇ ਵੀ ਭੁੱਲ ਨਹੀਂ ਸਕਦਾ ਅਤੇ ਉਸ ਤੋਂ ਬਾਅਦ ਵੀ ਮੈਂ ਚਿੱਤਰ ਕਾਫੀ ਬਣਵਾਏ ਪਰ ਮੈਂ ਕਦੇ ਵੀ ਮਤਲਬ ਮੇਰਾ ਅਖਬਾਰ ਵਿੱਚ ਜਾਂ ਕਿਸੇ ਰਸਾਲੇ ਵਿੱਚ ਨਹੀਂ ਆ ਪਾਇਆ ਪਰ ਮੈਂ ਮਤਲਬ ਆਪਣੇ ਆਪਣੇ ਮਤਲਬ ਨਿੱਜੀ ਤੌਰ 'ਤੇ ਹੀ ਚਿੱਤਰ ਬਣਾਉਂਦੀ ਹਾਂ ਆਪਣੇ ਖੁਸ਼ੀ ਦੇ ਲਈ ਆਪਣੇ ਮਨਪਰਚਾਵੇ ਦੇ ਲਈ ਨਾ ਕਿ ਮੈਂ ਇਸ ਲਈ ਬਣਾਉਂਦੀ ਆ ਕਿ ਮੇਰਾ ਕਿਸੇ ਅਖਬਾਰ ਵਿੱਚ ਕਿਸੇ ਰਸਾਲੇ ਦੇ ਵਿੱਚ ਆਵੇ ਪਰ ਜਦੋਂ ਮੈਂ ਬੱਚੀ ਸੀ ਤਾਂ ਮੈਨੂੰ ਸੀ ਕਿ ਹਾਂ ਕਿ ਮੇਰਾ ਵੀ ਆਏ ਪਹਿਲਾਂ ਆਇਆ ਸੀ ਅਤੇ ਮਤਲਬ ਮੈਨੂੰ ਬਹੁਤ ਖੁਸ਼ੀ ਹੋਈ ਸੀ ਪਰ ਹੁਣ ਮੈਨੂੰ ਇਹਨਾਂ ਚੀਜ਼ਾਂ ਤੋਂ ਖੁਸ਼ੀ ਨਹੀਂ ਮਿਲਦੀ ਹੈ ਅਤੇ ਮਤਲਬ ਹੁਣ ਮੇਰਾ ਮਨ ਨਹੀਂ ਕਰਦਾ ਕਿ ਆਏ ਬਟ ਪਹਿਲਾਂ ਸੀ ਅਤੇ ਹੁਣ ਨਹੀਂ ਹੈ ਇਸ ਲਈ ਮੈਂ ਉਹ ਕਦੇ ਨਹੀਂ ਭੁੱਲ ਸਕਦੀ ਕਿ ਮੇਰਾ ਚਿੱਤਰ ਕਿਸੇ ਸ਼ਨੀਵਾਰ ਵਾਲੇ ਅਖਬਾਰ ਦੇ ਵਿੱਚ ਆਇਆ ਸੀ ਅਤੇ ਉਹ ਮੈਂ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ